ਜੀ ਹਾਂ ਕਈ ਪਕਵਾਨ ਹਨ ਜੋ ਹਰ ਰੋਜ਼ ਤਿਆਰ ਕੀਤੇ ਜਾਂਦੇ ਹਨ ਅਤੇ ਉਨ੍ਹਾਂ ਨੂੰ ਸੈਲਾਨੀ ਅਜਮਾਉਣ ਲਈ ਖ਼ਾਸ ਮੰਨਿਆ ਜਾਂਦਾ ਹੈ ਕਈ ਉਦਾਹਰਣ ਹਨ ਦਾਲ ਚਾਵਲ ਰੋਟੀ ਸਬਜ਼ੀਆਂ ਆਦਿ ਇਹ ਘਰੇਲੂ ਬਣਤਨ ਬਣਤਰ ਹੁੰਦੇ ਹਨ ਅਤੇ ਸਟੋਰ 'ਤੇ ਵੀ ਮਿਲ ਸਕਦੇ ਹਨ ਹੋਰ ਕੁਝ ਪਕਵਾਨ ਹਨ ਜੋ ਰੋਜ਼ਾਨਾ ਤਿਆਰ ਕੀਤੇ ਜਾ ਸਕਦੇ ਹਨ ਸੈਲਾਨੀ ਦੀ ਮੰਨ ਪ੍ਰਗਤਾ ਵਾਸਤੇ ਉਹਨਾਂ ਦੇ ਅਦਾਨ ਪ੍ਰਦਾਨ ਕਰਨਾ ਸਹੀ ਹੁੰਦਾ ਹੈ ਆਲੂ ਗੋਭੀ ਇਹ ਪਕਵਾਨ ਨੂੰ ਆਮ ਤੋਰ 'ਤੇ ਹਰ ਘਰ ਵਿੱਚ ਬਣਾਇਆ ਜਾਂਦਾ ਹੈ ਅਤੇ ਇਸਨੂੰ ਸੈਲਾਨੀ ਦੌਰਾਨ ਚੁਣਨਾ ਬਹੁਤ ਅਸਾਨ ਹੁੰਦਾ ਹੈ ਚਾਵਲ ਅਤੇ ਦਾਲ ਦਾਲ ਚਾਵਲ ਇੱਕ ਓਰਾਤੀ ਓਰਤੇਕ ਪਕਵਾਨ ਹੈ ਜੋ ਪ੍ਰਤੀ ਦਿਨ ਤਿਆਰ ਕੀਤਾ ਜਾ ਸਕਦਾ ਹੈ ਅਤੇ ਸੈਲਾਨੀ ਵਿੱਚ ਖ਼ਾਸ ਤੋਰ 'ਤੇ ਪਸੰਦ ਕੀਤਾ ਜਾਂਦਾ ਹੈ ਤੇਹਰੀ ਇਹ ਭਾਰਤੀ ਪੁਰਾਤਨ ਖਾਣੇ ਵਿੱਚ ਇੱਕੋ ਹੈ ਅਕਸਰ ਸੈਲਾਨੀ ਤਿਆਰੀਆਂ ਵਿੱਚ ਇੱਕ ਬਹੁਤ ਉੁਪਯੋਗ ਕੀਤੀ ਜਾਂਦੀ ਹੈ ਇਹ ਕੁਝ ਉਦਾਰਨ ਹਨ ਜੋ ਰੋਜ਼ਾਨਾ ਤਿਆਰ ਕੀਤੇ ਜਾਂਦੇ ਹਨ ਅਤੇ ਇਹ ਸੈਲਾਨੀ ਦੌਰਾਨ ਪਸੰਦ ਕੀਤੇ ਜਾਂਦੇ ਹਨ